ਵਧੀਆ ਨਵੀ ਤੂੰ ਦੱਸ ਹੋਰ ਤੂੰ ਕੋਈ ਬੁੱਕ ਪੜ੍ਹਨੀ ਸਟਾਰਟ ਕੀਤੀ ਕਿਹੜੀ ਬੁੱਕ ਓਕੇ ਪੋਰਸ਼ੀਆ ਵਾਲੀ ਏ ਨਾ ਆਈ ਥਿੰਕ ਹਾਂ ਵੀਲੀਅਮ ਸ਼ੇਕਸਪਾਰੇ ਬਾ ਮੈਂ ਵੀ ਸੁਣਿਆ ਹੋਇਆ ਉਹਦੇ ਬਾਰੇ ਮੈਂ ਵੀ ਬਸ ਇਹ ਸੁਣਿਆ ਹੋਇਆ ਵੀ ਇਹ ਉਹਦੀ ਰਿਅਲ ਸਟੋਰੀ ਏ ਆਈ ਥਿੰਕ ਅਤੇ ਉਹਦੇ ਵਿੱਚ ਲੰਡਨ ਵਿੱਚ ਉੱਥੇ ਕੋਈ ਸਪੈਸ਼ਲ ਜਗ੍ਹਾ ਬਣੀ ਹੋਈ ਏ ਜਿੱਥੇ ਉਹਨੇ ਪੋਰਸ਼ੀਆ ਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਉੱਥੇ ਉਹਨੂੰ ਪਹਿਲੇ ਹੀ ਨਜ਼ਰ 'ਚ ਉਹਨੂੰ ਬਹੁਤ ਚੰਗੀ ਲੱਗੀ ਸੀ ਉਹ ਅਤੇ ਉੱਥੇ ਉਹਨੇ ਇਹ ਵੀ ਕਿਹਾ ਸੀ ਕਿ ਬੀ ਜਿਹੜਾ ਕੋਈ ਵੀ ਅਣਜਾਣ ਬੰਦਾ ਉੱਥੇ ਮਿਲੇਗਾ ਅਤੇ ਮੌਸਮ ਵੀ ਉਹਦੀ ਹਾਮੀ ਫੜੇਗਾ ਤਾਂ ਉਹ ਇੱਕ ਦੂਜੇ ਲਈ ਬਣੇ ਹੋਏ ਆ ਅਤੇ ਮੈਨੂੰ ਇਹ ਚੀਜ਼ ਬਹੁਤ ਇੰਟਰਸਟਿੰਗ ਲੱਗੀ ਪਰ ਮੈਂ ਕਦੇ ਬੁੱਕ ਨਹੀਂ ਪੜ੍ਹੀ ਤੂੰ ਪੜ੍ਹੀ ਹੋਈ ਹੈ ਇਹ ਅੱਛਾ ਤੂੰ ਮੈਨੂੰ ਥੋੜ੍ਹੀ ਦੱਸੇਂਗੀ ਫਿਰ ਤਾਂ ਕਿ ਮੈਂ ਵੀ ਇੰਟਰਸਟ ਬਣੇ ਮੇਰਾ ਅਤੇ ਮੈਂ ਵੀ ਪੜ੍ਹਾਂ ਇਹਦੇ ਵਿੱਚ ਆਈ ਥਿੰਕ ਤਿੰਨ ਕੰਡੀਸ਼ਨਸ ਹੁੰਦੀਆਂ ਏ ਨਾ ਉਹ ਕਿਹੜੀਆਂ ਸੀ ਓਕੇ ਠੀਕ ਹੈ ਜੀ ਓ ਹਾਂ ਮੈਂ ਹਾਂ ਇਹ ਤਾਂ ਮੈਂ ਬਹੁਤ ਇੰਟਰਸਟਿੰਗ ਆ ਮੈਂ ਵੀ ਜ਼ਰੂਰ ਪੜੂੰਗੀ ਇਹ ਠੀਕ ਹੈ ਓਕੇ